ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਐਮਾਜ਼ੋਨ ਕੰਪਨੀ ਤੋਂ ਬੋਲ ਰਹੇ ਹੋ ਹਾਂਜੀ ਸਰ ਮੈਂ ਇੱਕ ਪ੍ਰੋਡਕਟ ਮੰਗਵਾਇਆ ਸੀ ਡਵ ਸ਼ੈਪੂ ਦਾ ਹਾਂਜੀ ਐਮ ਔਨਲਾਈਨ ਮੰਗਵਾਇਆ ਸੀ ਹਾਂਜੀ ਮੈਨੂੰ ਮੇਰੇ ਤੱਕ ਉਹ ਪਹੁੰਚ ਗਿਆ ਹਾਂਜੀ ਉਹ ਪ੍ਰੋਡਕਟ ਤੁਹਾਡਾ ਬਹੁਤ ਵਧੀਆ ਹਾਂਜੀ ਇਹਦੇ ਨਾਲ ਬਾਲਾਂ ਦੀ ਗ੍ਰੋਥ ਬਹੁਤ ਵਧੀਆ ਹੁੰਦੀ ਆ ਬਾਲਾਂ ਬਹੁਤ ਸ਼ਾਇਨੀ ਰਹਿੰਦੇ ਨੇ ਹਾਂਜੀ ਅਤੇ ਉਹਦੇ ਮੈਂ ਹੋਰਾਂ ਨੂੰ ਵੀ ਬਹੁਤ ਸੁਜੈਸਟ ਕੀਤਾ ਇਹ ਵਾਲਾ ਯੂਸ ਕਰਨ ਵਾਸਤੇ

ਇਹ ਪ੍ਰੋਡਕਟ ਬਹੁਤ ਹੀ ਜ਼ਿਆਦਾ ਬੈਨੀਫਿਟ ਹੈ ਇਹਦੇ ਨਾਲ ਬਾਲਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਇਹਦੇ ਨਾਲ ਬਾਲਾਂ ਦੀ ਗ੍ਰੋਥ ਵਧਦੀ ਹੈ ਬਾਲ ਲੰਬੇ ਹੁੰਦੇ ਨੇ ਬਾਲ ਚਮਕਦਾਰ ਹੁੰਦੇ ਨੇ ਬਾਲ ਸ਼ਾਇਨੀ ਬਣਦੇ ਮੈਂ ਇਹ ਦੂਸਰਿਆਂ ਨੂੰ ਵੀ ਸੁਜੈਸਟ ਕੀਤਾ ਵੀ ਇਹ ਵਾਲਾ ਸ਼ੈਂਪੂ ਹੈ ਜਿਹੜਾ ਡਵ ਵਾਲਾ ਉਹ ਯੂਸ ਕਰੋ ਹਾਂਜੀ ਹਾਂਜੀ ਹਾਂਜੀ ਓਕੇ ਸਰ ਥੈਂਕ ਯੂ